ਕੁਝ ਦਿਨ ਪਹਿਲਾਂ ਮੈਂ ਆਪਣਾ ਡਰਾਈਵਿੰਗ ਲਾਇਸੰਸ ਆਨਲਾਈਨ ਅਪਡੇਟ ਕਰਨ ਲਈ ਦਿੱਤਾ ਸੀ ਅਤੇ ਮੈਨੂੰ ਉਸ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਰਹੀ ਹੈ ਤਾਂ ਮੈਂ ਗੂਗਲ 'ਤੇ ਪਰਿਵਾਹਨ ਸੇਵਾ ਹੈਲਪਲਾਈਨ ਨੰਬਰ ਸਰਚ ਕਰਕੇ ਉਹਨਾਂ ਨੂੰ ਕਾਲ ਕੀਤੀ ਅਤੇ ਮੈਨੂੰ ਉਹਨਾਂ ਨੇ ਉਹਨਾਂ ਨੂੰ ਕੋਲ ਕੀਤੀ ਅਗਰ ਅਤੇ ਮੈਨੂੰ ਉਸ ਬਾਰੇ ਕੋਈ ਅਪਡੇਟ ਦੱਸੀ ਜਾਵੇ ਕਿਰਪਾ ਕਰਕੇ ਮੇਰਾ ਆਨਲਾਈਨ ਲਾਈਸੈਂਸ ਜਲਦ ਤੋਂ ਜਲਦ ਮੈਨੂੰ ਪੋਸਟ ਕਰਵਾ ਦਿੱਤਾ ਜਾਵੇ ਮੇਰੀ ਬੇਨਤੀ ਹੈ